ਟੈਕਨੋਲਜੀ ਅੱਜ ਕੱਲ੍ਹ ਦੇ ਜਮਾਨੇ ਵਿੱਚ ਜਵਾਕਾਂ ਨੇ ਵੀ ਬਹੁਤ ਫਾਇਦੇ ਮੰਨਿਆ ਉਹਨਾਂ ਨੂੰ ਇਸ ਤੋਂ ਬਹੁਤ ਹੀ ਕੁਝ ਸਿੱਖਣ ਤੋਂ ਮਿਲਦਾ ਹੈ ਜਿਵੇਂ ਕਿ ਜਿਵੇਂ ਕਿ ਨੋ ਆਪਦੇ ਕੰਮ ਦੇ ਲਈ ਕੋਈ ਨੋਟਸ ਵਗੈਰਾ ਜਾਂ ਫਿਰ ਕੁਛ ਵੀ ਡਾਊਨਲੋਡ ਕਰਨਾ ਬਹੁਤ ਹੀ ਆਸਾਨੀ ਨਾਲ ਇਹ ਸਾਰੀ ਚੀਜ਼ਾਂ ਹੋ ਜਾਂਦੀਆਂ ਹਨ ਅਸੀਂ ਜਵਾਕ ਜਵਾਕਾਂ ਵਾਸਤੇ ਬਹੁਤ ਸਾਰੇ ਐਪ ਅਤੇ ਹੋਰ ਵੀ ਬਹੁਤ ਸਾਰੀਆਂ ਸਾਈਟਸ ਇੱਥੇ ਮਿਲ ਜਾਂਦੀਆਂ ਹਨ ਜੋ ਕਿ ਉਹਨਾਂ ਨੂੰ ਬਹੁਤ ਹੀ ਮਦਦ ਦਿੰਦੀਆਂ ਹਨ ਅਸੀਂ ਟੈਕਨੋਲਜੀ ਦੀ ਮਦਦ ਨਾਲ ਕਾਫੀ ਕੁਝ ਲਰਨ ਕਰ ਸਕਦੇ ਹਾਂ ਸਿੱਖ ਸਕਦੇ ਹਾਂ ਜਿਹਦੇ ਨਾਲ ਪੈਸੇ ਦੀ ਬਚਤ ਵੀ ਹੋ ਜਾਂਦੀ ਹੈ ਜਵਾਕਾਂ ਨੂੰ ਟਿਊਸ਼ਨ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ